ਸਮੇਂ ਦੇ ਨਾਲ ਨਾਲ ਪੰਜਾਬ ਦੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਬਹੁਤ ਬਦਲਾਅ ਆਏ ਆਏ ਹਨ ਜਿਸ ਤਰ੍ਹਾਂ ਕਿ ਪਹਿਲਾਂ ਪੰਜਾਬ ਦੀਆਂ ਔਰਤਾਂ ਆਪਣੇ ਘਰਾਂ ਤੱਕ ਹੀ ਸੀਮਿਤ ਸੀ ਉਹ ਆਪਦੇ ਘਰ ਦਾ ਚੁੱਲਾ ਚੌਂਕਾ ਕਰਦੀਆਂ ਸੀ ਪਸ਼ੂ ਵਗੈਰਾ ਨੂੰ ਸਾਂਭਦੀਆਂ ਸੀ ਪਿੰਡਾਂ ਵਿੱਚ ਜਿਹਨਾਂ ਦਾ ਕੰਮ ਘਰ ਤੋਂ ਬਾਹਰ ਉਹਨਾਂ ਨੂੰ ਮਤਲਬ ਸ਼ਹਿਰਾਂ ਬਾਰੇ ਤਾਂ ਕੁਛ ਪਤਾ ਹੀ ਨਹੀਂ ਸੀ ਪਰ ਜਿਹੜੀ ਅੱਜ ਦੀ ਨਾਰੀ ਹੈ ਹੌਲੀ ਹੌਲੀ ਜਿਵੇਂ ਜਿਵੇਂ ਉਹਨਾਂ ਦੀ ਸ਼ਿਕਸ਼ਾ ਮਤਲਬ ਪੜ੍ਹਾਈ ਵਧੀ ਅਤੇ ਉਹਨਾਂ ਨੂੰ ਸਮਾਜ ਦਾ ਪਤਾ ਲੱਗਿਆ ਅਤੇ ਉਹ ਹਰ ਖੇਤਰ ਵਿੱਚ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੀਆਂ ਸਨ ਇਸ ਲਈ ਹੁਣ ਅੱਜ ਦੀ ਔਰਤ ਅਤੇ ਪੁਰਾਣੇ ਜ਼ਮਾਨੇ ਔਰਤ ਵਿੱਚ ਬਹੁਤ ਫਰਕ ਹੈ ਅੱਜ ਦੀ ਔਰਤ ਤਾਂ ਡੋਕਟਰ ਵੀ ਹੈ ਟੀਚਰ ਵੀ ਹੈ ਅਤੇ ਹੋਰ ਕਈ ਤਰ੍ਹਾਂ ਦੀਆਂ ਫੈਕਟਰੀਆਂ ਵਗੈਰਾ ਜੇ ਹੋਰ ਕਿਸੇ ਵੀ ਫੀਲਡ ਵਿੱਚ ਆਪਾਂ ਦੇਖੀਏ ਤਾਂ ਉੱਥੇ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ ਅਤੇ ਕੋਈ ਪੁਲਿਸ ਵਿੱਚ ਵੀ ਦੇਖੋ ਕਿੰਨੀਆਂ ਆਪਣੀਆਂ ਮਿਲਟਰੀ ਤੱਕ ਔਰ ਬਹੁਤ ਜਗ੍ਹਾ ਆਪਾਂ ਦੇਖੀਏ ਮਤਲਬ ਕੋਈ ਜਗ੍ਹਾ ਇਹ ਜੀ ਹੈ ਹੀ ਨਹੀਂ ਵੀ ਜਿੱਥੇ ਮ ਅੱਜ ਕੱਲ੍ਹ ਔਰਤਾਂ ਦੀ ਭੂਮਿਕਾ ਨਾ ਹੋਵੇ ਹਰ ਖੇਤਰ ਵਿੱਚ ਔਰਤਾਂ ਨੇ ਔਰ ਮੈਂ ਖੁਦ ਇੱਕ ਸਿਕਿਉਰਟੀ ਪੰਜਾਬ ਸੈਂਟਰ ਯੂਨੀਵਰਸਿਟੀ ਸਿਕਿਊਰਟੀ ਦੀ ਜੋਬ ਕਰਦੀ ਹਾਂ ਔਰ ਮੈਨੂੰ ਇੱਥੇ ਜੋਬ ਕਰਦੇ ਸੱਤ ਸਾਲ ਹੋ ਗਏ ਔਰ ਮੈਂ ਇੱਥੇ ਔਰਤਾਂ ਦੀ ਬਹੁਤ ਜ਼ਿਆਦਾ ਤਰੱਕੀ ਨੂੰ ਦੇਖਦੀ ਹਾਂ ਜਿਹਨਾਂ ਵਿੱਚੋਂ ਕਈ ਤਰਾਂ ਔਰਤਾਂ ਸਾਡੇ ਵਿੱਚ ਪ੍ਰੋਫੈਸਰ ਨੇ ਜੋ ਮਤਲਬ ਬਹੁਤ ਵਧੀਆ ਕੰਮ ਕਰਦੀਆਂ ਨੇ ਹੋਰ ਕਈ ਤਰ੍ਹਾਂ ਦੀਆਂ ਮਤਲਬ ਕੋਈ ਵੀ ਔਰਤਾਂ ਅੱਜ ਕੱਲ੍ਹ ਹੁਣ ਘਰ ਬੈਠ ਕੇ ਰਾਜ਼ੀ ਹੀ ਨਹੀਂ ਸਾਡੀ ਯੂਨੀਵਰਸਿਟੀ ਆਸੇ ਪਾਸੇ ਹੀ ਕਿੰਨੀਆਂ ਔਰਤਾਂ ਜਿਹੜੀਆਂ ਪਹਿਲਾਂ ਘਰੇ ਰਹਿੰਦੀਆਂ ਸਨ ਹੁਣ ਉਹਨਾਂ ਨੂੰ ਅੱਜ ਇੱਥੇ ਬਹੁਤ ਵਧੀਆ ਰੁਜ਼ਗਾਰ ਮਿਲਿਆ ਹੋਇਆ ਹੈ ਉਹ ਇੱਥੇ ਕਈ ਔਰਤਾਂ ਸਫਾਈ ਦਾ ਹੀ ਕੰਮ ਕਰਦੀਆਂ ਨੇ ਕਈ ਹੋਰ ਮੈੱਸਾਂ ਵਿੱਚ ਹੋਰ ਖਾਣੇ ਬਣਾਉਂਦੀਆਂ ਨੇ ਔਰ ਕਈਆਂ ਨੇ ਇੱਥੇ ਆਸੇ ਪਾਸੇ ਸਿਲਾਈ ਸੈਂਟਰ ਖੋਲ੍ਹਿਆ ਬਿਊਟੀ ਪਾਰਲਰ ਖੋਲ੍ਹ ਲਏ ਹੈ ਅਤੇ ਹੋਰ ਬਹੁਤ ਤਰ੍ਹਾਂ ਦੇ ਕੰਮ ਵੀ ਔਰਤਾਂ ਕਰ ਰਹੀਆਂ ਕੋਈ ਵੀ ਇਹ ਜਿਹਾ ਖੇਤਰ ਹੈ ਹੀ ਨਹੀਂ ਜਿੱਥੇ ਵੀ ਔਰਤਾਂ ਕੰਮ ਅੱਜ ਨਾ ਕਰ ਸਕਦੀਆਂ ਹੋਣ